ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਰਾਹੁਲ ਲਲੋਤਰਾ ਮੈਂ ਤੁਹਾਡੇ ਵੈਬਸਾਈਟ ਦੇ ਥਰੂ ਆਪਣੇ ਲਈ ਇੱਕ ਗੱਡੀ ਬੁੱਕ ਕੀਤੀ ਸੀ ਇਹ ਗੱਡੀ ਮੈਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾਣ ਲਈ ਕੀਤੀ ਸੀ ਇਸ ਦਾ ਸਮਾਂ ਮੈਂ ਸਵੇਰ ਦੇ ਸਾਢੇ ਛੇ ਵਜੇ ਚੌਵੀ ਮਾਰਚ ਦੋ ਹਜ਼ਾਰ ਚੌਵੀ ਲਈ ਰੱਖਿਆ ਸੀ ਤੇ ਮੈਂ ਨੌਂ ਵਜੇ ਤੋਂ ਪਹਿਲਾਂ ਪਹਿਲਾਂ ਅੰਮ੍ਰਿਤਸਰ ਪੁੱਜਣਾ ਸੀ ਇਸ ਇਸ ਦਾ ਡਰਾਈਵਰ ਦਾ ਨਾਮ ਐਹ ਸੀ ਅਤੇ ਮੈਂ ਇਸ ਦੇ ਨਾਲ ਇੱਕ ਦਿਨ ਪਹਿਲਾਂ ਸ਼ਾਮ ਨੂੰ ਗੱਲ ਵੀ ਕੀਤੀ ਸੀ ਕਿ ਉਹ ਮੇਕੇ ਕੋਲ ਸਵੇਰੇ ਸਾਢੇ ਛੇ ਵਜੇ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਪੁੱਜ ਜਾਵੇ ਉਸ ਵੇਲੇ ਡਰਾਈਵਰ ਨੇ ਤਾਂ ਮੈਨੂੰ ਕਿਹਾ ਸੀ ਉਹ ਮੇਰੇ ਕੋਲ ਪੁੱਜ ਜਾਵੇਗਾ ਟਾਈਮ ਨਾਲ ਪਰ ਸਵੇਰੇ ਉਹ ਟਾਈਮ ਨਾਲ ਨਹੀਂ ਪੁੱਜਿਆ ਮੈਂ ਉਸਦੇ ਉਡੀਕ ਕਰਦਾ ਰਿਹਾ ਉਸ ਸਵੇਰੇ ਮੇਰੇ ਕੋਲ ਅੱਠ ਵਜੇ ਨਾਲ ਆਇਆ ਅਤੇ ਜਿਸ ਕਰਕੇ ਮੇਰੀ ਫਲੈਟ ਮਿਸ ਹੋ ਗਈ ਅਤੇ ਮੈਂ ਹੁਣ ਤੁਹਾਡੇ ਤੋਂ ਇਹ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਪੈਸੇ ਦਾ ਭੁਗਤਾਨ ਸਾਰਾ ਵਾਪਿਸ ਕਰੋ ਅਤੇ ਉਸ ਡਰਾਈਵਰ ਨੂੰ ਵੀ ਕੱਢ ਦਿਓ ਕਿਉਂਕਿ ਇਸ ਕਰਕੇ ਮੇਰੀ ਜ਼ਰੂਰੀ ਫਲੈਟ ਮਿਸ ਹੋਈ ਹੈ